ਹਾਂ ਆਮ ਤੌਰ ਤੇ ਪਸ਼ੂ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹਨ ਜਿਵੇਂ ਕਿ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਪੈਰ ਗ ਗਲ ਜਾਂਦੇ ਹਨ ਜਿਸ ਨਾਲ ਪਸ਼ੂਆਂ ਨੂੰ ਬਹੁਤ ਬੈਠਣ ਵਿੱਚ ਦਿੱਕਤ ਆਉਂਦੀ ਹੈ ਅਤੇ ਇਹਨਾਂ ਦਾ ਇਲਾਜ ਨਾ ਕੀਤੇ ਜਾਣ ਤੇ ਪਸ਼ੂ ਮਾਰ ਵੀ ਸਕਦੇ ਹਨ ਫਲੂ ਫੈਲ ਜਾਂਦੇ ਹਨ ਅਤੇ ਪਸ਼ੂਆਂ ਦਾ ਖੂਨ ਪਤਲਾ ਹੋ ਜਾਂਦਾ ਹੈ ਉਸ ਨਾਲ ਵੀ ਪਸ਼ੂ ਬਹੁਤ ਕਮਜ਼ੋਰ ਹੋ ਜਾਂਦੇ ਹਨ ਉਸ ਨਾਲ ਪਸ਼ੂ ਮਰ ਵੀ ਸਕਦੇ ਹਨ ਜੇਕਰ ਸਮੇਂ ਸਿਰ ਇਲਾਜ ਨਾ ਹੋ ਸਕੇ ਫਿਰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਤੁਸੀਂ ਬਿਮਾਰ ਹੋ ਜਾਵੇ ਤਾਂ ਉਸ ਦਾ ਧਿਆਨ ਬਹੁਤ ਰੱਖਣਾ ਪੈਂਦਾ ਹੈ ਉਸ ਕੋਲ ਰਹਿਣਾ ਪੈਂਦਾ ਹੈ ਉਸ ਨੂੰ ਡਾਕਟਰ ਦਾ ਟਰੀਟਮੈਂਟ ਵੀ ਕਰਾਉਣਾ ਪੈਂਦਾ ਹੈ